ਅਨਮੋਲ ਜੋ ਕਿ ਬੱਚੇ ਦਾ ਨਾਮ ਹੈ ਜਿਸ ਦਾ ਭਾਰ ਰਜਿਸਟਰੇਸ਼ਨ ਫਾਰਮ ਵਿੱਚ ਪੰਜ ਕਿੱਲੋ ਦਰਜ ਹੈ ਉਹ ਗਲਤ ਹੈ ਬਲਕਿ ਉਸ ਦਾ ਭਾਰ ਅੱਠ ਕਿੱਲੋ ਹੈ ਇਹ ਭਾਰ ਗਲਤ ਦਰਜ ਕੀਤਾ ਗਿਆ ਹੈ ਜਦੋਂ ਭਾਰ ਚੈੱਕ ਕਰਵਾਇਆ ਗਿਆ ਅਤੇ ਹੋਸਪਿਟਲ ਦੀ ਰਿਪੋਰਟ ਦੇ ਵੀ ਮੁਤਾਬਕ ਭਾਰ ਅੱਠ ਕਿੱਲੋ ਹੈ ਤਾਂ ਇਸਨੂੰ ਸਹੀ ਕੀਤਾ ਜਾਵੇ ਕਿਉਂਕਿ ਜਦੋਂ ਰਜਿਸਟਰੇਸ਼ਨ ਫਾਰਮ ਵਿੱਚ ਗਲਤੀ ਹੋ ਗਈ ਹੈ ਤਾਂ ਇਹ ਸਰਟੀਫਿਕੇਟ ਵਿੱਚ ਵੀ ਗਲਤ ਛਪੇਗੀ ਅਤੇ ਦਸਤਾਵੇਜ਼ ਜੋ ਕਿ ਹੋਸਪਿਟਲ ਦੀ ਰਿਪੋਰਟ ਅਤੇ ਭਾਰ ਚੈੱਕ ਕਰਨ 'ਤੇ ਅੱਠ ਕਿੱਲੋ ਹੈ ਤਾਂ ਇਹ ਸਬੂਤ ਹੈ ਅਤੇ ਭਾਰ ਨੂੰ ਜਲਦੀ ਤੋਂ ਜਲਦੀ ਸਹੀ ਕੀਤਾ ਜਾਵੇ ਤਾਂ ਜੋ ਸਰਟੀਫਿਕੇਟ ਵੀ ਸਹੀ ਬਣੇ